ਪੰਜਾਬੀ ਭਾਸ਼ਾ ਇੱਕ ਅਸ ਬਹੁਤ ਵਧੀਆ ਭਾਸ਼ਾ ਹੈ ਜਿਹੜੀ ਇੱਕ ਬਹੁਤ ਮਿੱਠ ਬੋਲੜੀ ਭਾਸ਼ਾ ਹੈ ਇਹ ਇੱਕ ਪ ਪਾਸੇ ਨੂੰ ਪੂਰੇ ਰੋਅਬ ਵਾਲ਼ੀ ਇੱਕ ਪਾਸੇ ਨੂੰ ਮਿੱਠ ਬੋਲੜੀ ਵੀ ਹੈ ਇਸ ਵਿੱਚ ਬਹੁਤ ਸ਼ਬਦ ਇਹੋ ਜਿਹੇ ਹਨ ਜੋ ਤੁਹਾਨੂੰ ਦਿਲਚਸਪ ਲੱਗਣਗੇ ਜਿਸ ਤਰ੍ਹਾਂ ਕਿ ਙ ਞ ਣ ੜ ਸ਼ਬਦ ਹੈ ਇੱਕ ਜੋ ਅੰਗਰੇਜ਼ ਵੀ ਨਹੀਂ ਬੋਲ਼ ਸਕਦੇ ਇਸ ਨੂੰ